ਦੇਸ਼ ਵਿੱਚ ਉਪਲਬਧ ਹਸਪਤਾਲਾਂ ਅਤੇ ਡਾਕਟਰੀ ਸੇਵਾਵਾਂ ਦਾ ਬਹੁਤ ਹੀ ਵਧੀਆ ਪ੍ਰਬੰਧ ਹੈ ਲੋਕਾਂ ਨੂੰ ਜਿੱਥੇ ਵੀ ਕੁਝ ਵੀ ਚਾਹੀਦਾ ਹੁੰਦਾ ਹੈ ਹਰ ਪਾਸੇ ਹਰ ਥਾਂ 'ਤੇ ਬਹੁਤ ਹੀ ਨਜ਼ਦੀਕ ਨਜ਼ਦੀਕ ਹੋਸਪਿਟਲਸ ਨੇ ਜਿਹਦੇ ਵਿੱਚ ਹਰ ਫਸੀਲਿਟੀ ਅਵੇਲੇਬਲ ਹੈ ਜੇ ਕੋਈ ਬਹੁਤ ਹੀ ਜ਼ਿਆਦਾ ਫਾਨੈਂਸ਼ੀਅਲੀ ਸਟਰੋਂਗ ਨਹੀਂ ਹੈਗਾ ਬਹੁਤ ਹੀ ਗਰੀਬ ਘਰ ਦਾ ਹੈ ਉਹਦੇ ਲਈ ਸਰਕਾਰੀ ਹਸਪਤਾਲ ਵੀ ਹੈਗੇ ਨੇ ਜਿੱਥੇ ਉਹਨਾਂ ਨੂੰ ਮੁਫਤ ਸਾਰੀ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ ਪਹਿਲਾਂ ਤੋਂ ਹੁਣ ਬਹੁਤ ਬਿਹਤਰ ਹੋ ਚੁੱਕਾ ਹੈ ਸਭ ਕਿਉਂਕਿ ਹੁਣ ਵਧਦੇ ਜ਼ਮਾਨੇ ਦੇ ਨਾਲ ਲੋਕਾਂ ਦੇ ਵਿੱਚ ਜਾਗਰੂਕਤਾ ਆਉਂਦੀ ਪਈ ਹੈ ਅਤੇ ਉਹ ਇਸ ਚੀਜ਼ ਨੂੰ ਬਹੁਤ ਹੀ ਚੰਗੀ ਤਰ੍ਹਾਂ ਲੈਂਦੇ ਹਨ ਕਿ ਮੈਡੀਕਲ ਚੀਜ਼ ਇੱਕ ਬਹੁਤ ਹੀ ਤੁਸੀਂ ਕਹਿ ਸਕਦੇ ਹੋ ਕਿ ਚੰਗੀ ਹੈ ਅੱਜ ਕੱਲ੍ਹ ਦੀ ਜਿਹੜੀ ਵੀ ਸੁਧਾ ਸੁਵਿਧਾਵਾਂ ਉਹ ਦਿੰਦੇ ਨੇ ਜਿਵੇਂ ਫਰੀ ਟੈਸਟ ਹੋ ਗਏ ਨੇ ਕਈ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਨੇ ਟੈਸਟ ਨੇ ਜਾਂ ਇੱਦਾਂ ਦੇ ਇਲਾਜ ਨੇ ਜੋ ਬਿਲਕੁਲ ਫਰੀ ਦਿੱਤੇ ਜਾਂਦੇ ਹਨ ਜੋ ਬਹੁਤ ਹੀ ਵਧੀਆ ਡੋਕਟਰਸ ਨੇ ਜੋ ਇੱਕ ਤਜਰਬਾ ਰੱਖਦੇ ਹਨ ਇਸ ਦੇਸ਼ ਦੇ ਵਿੱਚ ਉਹ ਕਦੇ ਕਦੇ ਸਾਲ ਦੇ ਵਿੱਚ ਇੱਕ ਅੱਧੀ ਵਾਰ ਆਪਣਾ ਫਰੀ ਕੈਂਪ ਵੀ ਲਾਉਂਦੇ ਹਨ ਜਿੱਥੇ ਉਹ ਗਰੀਬ ਲੋਕਾਂ ਦਾ ਇਲਾਜ ਕਰਦੇ ਹਨ ਉਹ ਵੀ ਬਿਲਕੁਲ ਮੁਫਤ ਅਤੇ ਇਸ ਤੋਂ ਵਧੀਆ ਫਿਰ ਹੋਰ ਕੀ ਹੋ ਸਕਦਾ ਹੈ ਅਤੇ ਮਹਾਂਮਾਰੀ ਦੇ ਵਿੱਚ ਮੇਰਾ ਅਨੁਭਵ ਬਹੁਤ ਹੀ ਠੀਕ ਸੀ ਲਾਈਕ ਘਰ ਹੀ ਹੁੰਦੀ ਸੀ ਮੈਂ ਅਤੇ ਮੈਨੂੰ ਕੁਝ ਇੰਨਾਂ ਇਫੈਕਟ ਨਹੀਂ ਹੋਇਆ ਕਿਉਂਕਿ ਬਾਹਰ ਦੁਨੀਆ ਦੇ ਵਿੱਚ ਜੋ ਹੋਇਆ ਉਹਨੂੰ ਵੇਖ ਕੇ ਜ਼ਰੂਰ ਕੁਛ ਹੁੰਦਾ ਹੀ ਕੀ ਹੈ ਕੀ ਹੁੰਦਾ ਪਿਆ ਹੈ ਅਤੇ ਇੱਦਾਂ ਨਹੀਂ ਹੋਣਾ ਚਾਹੀਦਾ ਬਟ ਉਸ ਮਹਾਂਮਾਰੀ ਤੋਂ ਅਸੀਂ ਬਾਹਰ ਆ ਚੁੱਕੇ ਹਾਂ ਅਤੇ ਇਹ ਬਹੁਤ ਵੱਡੀ ਗੱਲ ਹੈ ਕਿ ਹੁਣ ਉੱਦਾਂ ਦਾ ਕੋਈ ਖਤਰਾ ਸਾਡੇ ਦੇਸ਼ ਦੇ ਨਹੀਂ ਹੈਗਾ ਸਿਹਤ ਦੇਖਭਾਲ ਦੇ ਪ੍ਰਾਪਤ ਸੁਧਾਰ ਇਹ ਹੋਣਾ ਚਾਹੀਦਾ ਕਿ ਬਸ ਜਿੱਥੇ ਕਈ ਡੋਕਟਰਸ ਆਪਣੇ ਆਪ ਨੂੰ ਕਰੱਪਸ਼ਨ ਵਿੱਚ ਜਾ ਰਹੇ ਹਨ ਉਹ ਸਿਰਫ ਅਮੀਰਾਂ ਦੇ ਇਲਾਜ ਕਰਦੇ ਉਹਨਾਂ ਕੋਲ ਪੈਸੇ ਲੈ ਕੇ ਉਹਨਾਂ ਦਾ ਕੰਮ ਕਰਦੇ ਹਨ ਉਹਨਾਂ ਦੇ ਪ੍ਰਤੀ ਥੋੜ੍ਹੇ ਜਿਹੇ ਹੋਰ ਸਖਤਾਈ ਕੀਤੀ ਜਾਵੇ ਤਾਂ ਕਿ ਉਹ ਅਜਿਹੇ ਕੰਮ ਕਰਨੇ ਛੱਡ ਦੇਣ ਅਤੇ ਬਾਕੀ ਡੋਕਟਰੀ ਲਾਈਨ 'ਚ ਇੱਦਾਂ ਦੀ ਕੋਈ ਵੀ ਚੀਜ਼ ਨਹੀਂ ਹੈਗੀ ਜਿਹਨੂੰ ਅਸੀਂ ਬਦਲਣਾ ਚਾਹਵਾਂਗੇ ਜਾਂ ਉਹਨੂੰ ਠੀਕ ਕਰਨਾ ਚਾਹਵਾਂਗੇ